ਅੰਮ੍ਰਿਤਸਰ ਦੀ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਜਿਨ੍ਹਾਂ ਨੂੰ ਕਿ ਸ਼੍ਰੀ ਰਾਮਦਾਸ ਜੀ ਨੇ ਸਥਾਪਿਤ ਕੀਤਾ ਸੀਗਾ ਅਤੇ ਇੱਥੇ ਇੱਥੋਂ ਦੇ ਸਾਰੇ ਸਿੱਖ ਇੱਥੇ ਬਹੁਤ ਜ਼ਿਆਦਾ ਜਾਂਦੇ ਹਨ ਜਿਨ੍ਹਾਂ ਦਾ ਕਿ ਅੰਮ੍ਰਿਤਸਰ ਇੱਕ ਸਿੱਖ ਇਤਿਹਾਸ ਹੈ ਕਿ ਜਿੱਥੇ ਦਿਵਾਲੀ ਵੀ ਬਹੁਤ ਧੀਮ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇੱਥੇ ਕਿ ਸਿੱਖਾਂ ਦੇ ਰਿਲੇਟਡ ਸਾਰੇ ਹੀ ਗੁਰਦੁਆਰੇ ਨੇ ਇੱਥੇ ਅਤੇ ਸਾਰੇ ਗੁਰੂਆਂ ਦਸਾਂ ਗੁਰੂਆਂ ਨੂੰ ਮਿਲਾ ਕੇ ਇਹ ਅੰਮ੍ਰਿਤਸਰ ਬਣਿਆ ਹੋਇਆ ਹੈ ਜੋ ਕਿ ਅੰਮ੍ਰਿਤਸਰ ਵੇਖਣ ਵਿੱਚ ਵੀ ਬਹੁਤ ਸੋਹਣਾ ਇੱਥੇ ਬਹੁਤ ਜ਼ਿਆਦਾ ਟੂਰਿਸਟ ਅਤੇ ਸਿੱਖ ਅਤੇ ਹੋਰ ਸਾਰ ਸਾਰੇ ਦੁਨੀਆ ਤੋਂ ਲੋਕ ਇੱਥੇ ਆਉਂਦੇ ਜਾਂਦੇ ਹਨ ਅਤੇ ਗੋਲਡਨ ਟੈਂਪਲ ਨੂੰ ਵੇਖਦੇ ਹਨ ਅੰਮ੍ਰਿਤਸਰ ਵਿੱਚ ਅ ਅੰਮ੍ਰਿਤਸਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜਦੋਂ ਮੈਂ ਇੱਥੇ ਅੰਮ੍ਰਿਤਸਰ ਘੁੰਮਣ ਗਈ ਸੀ ਤਾਂ ਮੈਨੂੰ ਉੱਥੇ ਜਾ ਕੇ ਬਹੁਤ ਹੀ ਸਕੂਨ ਮਿਲਿਆ ਹੈ ਬਹੁਤ ਹੀ ਜ਼ਿਆਦਾ ਵਧੀਆ ਫੀਲ ਹੋਇਆ ਅੰਮ੍ਰਿਤਸਰ ਜਾਣ ਦਾ ਮੌਕਾ ਮੈਨੂੰ ਕਾਫ਼ੀ ਵਾਰ ਮਿਲਿਆ ਹੈ ਅਤੇ ਮੈਨੂੰ ਉੱਥੇ ਜਾਣ ਮੇਰਾ ਉੱਥੇ ਜਾਣ ਦਾ ਤਜਰਬਾ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੈ ਕਿਉਂਕਿ ਮੈਨੂੰ ਉੱਥੇ ਜਾ ਕੇ ਬਹੁਤ ਹੀ ਸ਼ਾਂਤੀ ਮਿਲੀ ਅੱਤੇ ਮੈਂ ਉਥੇ ਬਹੁਤ ਹੀ ਜ਼ਿਆਦਾ ਘੁੰਮਿਆ ਫਿਰਿਆ ਹੈ ਨਾ ਬਾਜ਼ਾਰ ਵੀ ਉੱਥੋਂ ਦੇ ਬਾਜ਼ਾਰ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਮੈਂ ਉੱਥੇ ਬਹੁਤ ਜ਼ਿਆਦਾ ਖਰੀਦੀ ਖਰੀਦਾ ਖਰਾਦੀ ਕੀਤੀ ਕੁਛ ਹੈ ਨਾ ਅਤੇ ਅੰਮ੍ਰਿਤਸਰ ਇੱਕ ਬਹੁਤ ਹੀ ਵਧੀਆ ਇਤਿਹਾਸਿਕ ਹੈ ਜਗ੍ਹਾ ਹੈ ਜਿੱਥੇ ਕਿ ਹਰੇਕ ਜਾਂਦਾ ਹੈ ਟੂਰਿਸਟ ਵਗੈਰਾ ਉੱਥੇ ਆਉਂਦੇ ਜਾਂਦੇ ਰਹਿੰਦੇ ਹਨ ਬਾਹਰੋਂ ਵੀ ਲੋਕ ਅੰਮ੍ਰਿਤਸਰ ਨੂੰ ਵੇਖਣ ਆਉਂਦੇ ਹਨ ਜੋ ਕਿ ਬਹੁਤ ਹੀ ਸੋਹਣਾ ਸ਼ਹਿਰ ਹੈ ਮੈਨੂੰ ਉੱਥੇ ਜਾਣ ਦਾ ਬਹੁਤ ਵਾਰ ਮੌਕਾ ਮਿਲਿਆ ਅਤੇ ਅਗਾਂਹ ਵੀ ਮੈਂ ਚਾਹੁੰਦਾ ਕਿ ਮੈਨੂੰ ਉੱਥੇ ਜਾਣ ਦਾ ਮੌਕਾ ਮਿਲੇ ਅੰਮ੍ਰਿਤਸਰ ਬਹੁਤ ਹੀ ਵਧੀਆ ਇੱਕ ਇਤਿਹਾਸਿਕ ਜਗ੍ਹਾ ਹੈ ਨਾ ਇਤਿਹਾਸਿਕ ਜਗ੍ਹਾ ਹੈ ਉੱਥੋ ਉੱਥੇ ਹਰ ਟਾਈਮ ਗੁਰਦੁਆਰਾ ਵਿੱਚ ਲੰਗਰ ਚੱਲਦਾ ਰਹਿੰਦਾ ਹੈ ਕੋਈ ਵੀ ਉੱਥੋਂ ਭੁੱਖਾ ਨਹੀਂ ਮੁੜਦਾ ਅੰਮ੍ਰਿਤਸਰ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਵੀ ਜਾਂਦੇ ਜਦੋਂ ਉੱਥੇ ਕੋਈ ਵੀ ਜਾਂਦਾ ਹੈ ਨਾ ਉੱਥੇ ਰੋਟੀ ਪਾਣੀ ਦਾ ਵੀ ਔਖਾ ਨਹੀਂ ਹੁੰਦਾ ਕਿਉਂਕਿ ਉੱਥੇ ਥਾਂ ਥਾਂ ਲੰਗਰ ਲੱਗੇ ਹੁੰਦੇ ਹਨ ਅਤੇ ਉੱਥੇ ਹਰ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ ਉੱਥੇ ਜਾ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਬਹੁਤ ਉੱਥੇ ਬਾਜ਼ਾਰ ਉੱਥੋਂ ਦੇ ਬਾਜ਼ਾਰ ਬਹੁਤੇ ਉੱਭਰੇ ਹੁੰਦੇ ਨੇ ਜਦੋਂ ਮੈਂ ਇੱਥੇ ਗਿਆ ਸੀ ਉੱਥੇ ਜਾ ਕੇ ਬਹੁਤ ਜ਼ਿਆਦਾ ਸ਼ੋਪਿੰਗ ਕੀਤੀ ਅਤੇ ਹਰੇਕ ਬਹੁਤ ਜ਼ਿਆਦਾ ਗੁਰਦੁਆਰਾ ਗੁਰਦੁਆਰਿਆਂ ਵਿੱਚ ਗਿਆ ਜਿੱਥੇ ਜਾ ਕੇ ਮੈਨੂੰ ਬਹੁਤ ਸਕੂਨ ਮਿਲਿਆ ਸ਼ਾਂਤੀ ਮਿਲੀ ਅੱਗੇ ਵੀ ਮੈਂ ਚਾਹੁੰਦਾ ਕਿ ਮੈਨੂੰ ਮੈਂ ਜਦ ਵੀ ਅੰਮ੍ਰਿਤਸਰ ਜਾਵਾਂ ਅਤੇ ਮੈਨੂੰ ਮੈਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਮਿਲੇ ਅਤੇ ਮੈਂ ਸਾਰੀ ਜਗ੍ਹਾ ਕਿਉਂਕਿ ਅੰਮ੍ਰਿਤਸਰ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਸ਼ਹਿਰ ਅਤੇ ਬਹੁਤ ਹੀ ਵਧੀਆ ਸ਼ਹਿਰ ਉੱਥੋਂ ਦਾ ਸ਼ਹਿਰ ਵੀ ਇਸ ਤਰ੍ਹਾਂ ਲੈ ਕੇ ਉੱਥੇ ਸਿੱਖ ਇਤਿਹਾਸ ਬਣਿਆ ਹੋਇਆ ਹੈ